ਭਾਸ਼ਾ ਭਾਸ਼ਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਭਾਸ਼ਾ ਦੇ ਬਾਰੇ ਭਾਸ਼ਾ ਇੱਕ ਸੰਚਾਰ ਦਾ ਸਾਧਨ ਹੈ ਅਤੇ ਅਸੀਂ ਆਪਣੇ ਜੋ ਵੀ ਮਨ ਦੇ ਵਿਚਾਰ ਹੁੰਦੇ ਨੇ ਅਸੀਂ ਨ ਇਸਨੂੰ ਆਪਣੀ ਭਾਸ਼ਾ ਦੇ ਰਾਹੀਂ ਪ੍ਰਗਟ ਕਰ ਸਕਦੇ ਹਾਂ ਅਤੇ ਉਪਭਾਸ਼ਾ ਹੁੰਦੀ ਹੈ ਇਹ ਹਰ ਇਲਾਕੇ ਦੀ ਆਪਣੀ ਆਪਣੀ ਵੱਖਰੀ ਵੱਖਰੀ ਭਾਸ਼ਾ ਹੁੰਦੀ ਹੈ ਹਰ ਇਲਾਕਾ ਜਿਦੋ ਦੇ ਲੋਕ ਰਹਿੰਦੇ ਨੇ ਮਾਝੀ ਹੋ ਗਈ ਦੁਆਬੀ ਹੋ ਗਈ ਉੱਧਰ ਦੇ ਲੋਕ ਉੱਦਾਂ ਦੀ ਹੀ ਭਾਸ਼ਾ ਬੋਲਦੇ ਨੇ ਪੰਜਾਬ ਦੇ ਲੋਕ ਪਿਓਰ ਪੰਜਾਬੀ ਬੋਲਦੇ ਨੇ ਪੰਜਾਬੀ ਭਾਸ਼ਾ ਬਾਕੀ ਰਾਜ ਦੀਆਂ ਉਪਭਾਸ਼ਾ ਤੋਂ ਇਸ ਕਰਕੇ ਵੱਖਰੀ ਹੈ ਕਿਉਂਕਿ ਇਹਨੂੰ ਸਮਝਣਾ ਬਹੁਤ ਸੌਖਾ ਅਸੀਂ ਆਪਣੇ ਵਿਚਾਰਾਂ ਨੂੰ ਅਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਪੰਜਾਬੀ ਭਾਸ਼ਾ 'ਚ ਪ੍ਰਗਟ ਕਰ ਸਕਦੇ ਹਾਂ ਅਤੇ ਇਹਨੂੰ ਹਰ ਰਾਜ ਦੇ ਖੇਤਰ ਦੇ ਲੋਕ ਪੰਜਾਬੀ ਭਾਸ਼ਾ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝ ਵੀ ਸਕਦੇ ਨੇ ਅਤੇ ਦੂਜੇ ਰਾਜ ਦੀਆਂ ਜਿਹੜੀਆਂ ਭਾਸ਼ਾਵਾਂ ਹੁੰਦੀਆਂ ਨੇ ਉਹਨਾਂ ਨੂੰ ਸਮਝਣਾ ਵੀ ਔਖਾ ਹੁੰਦਾ ਹੈ ਕਿਉਂਕਿ ਜਿਹੜੇ ਉਪਭਾਸ਼ਾ ਹੁੰਦੀ ਹੈ ਨਾ ਕਿਸੇ ਵੀ ਰਾਜ ਦੀ ਉਹ ਇੱਕ ਸੀਮਿਤ ਦਾਇਰੇ ਵਿੱਚ ਬੋਲੀ ਜਾਂਦੀ ਹੈ ਉਹਨੂੰ ਉੱਧਰ ਨਹੀਂ ਬੋਲਿਆ ਜਾਂਦਾ ਸਾਡੇ ਪੰਜਾਬੀ ਲੋਕ ਦੂਜੇ ਕਿਸੇ ਰਾਜ 'ਚ ਜਾਣਗੇ ਉਹ ਉਸ ਇਲਾਕੇ ਦੀ ਭਾਸ਼ਾ ਨੂੰ ਜੋ ਉਹ ਬੋਲ ਰਹੇ ਨੇ ਗੱਲ ਕਰ ਰਹੇ ਨੇ ਉਹਨੂੰ ਸਮਝਣਾ ਦਿੱਕਤ ਹੋ ਜਾਏਗੀ ਪਰ ਜੇ ਸਾਡੇ ਪੰਜਾਬੀ ਲੋਕ ਕਿਸੇ ਦੂਸਰੇ ਰਾਜ 'ਚ ਜਾਂਦੇ ਨੇ ਅਤੇ ਅਸੀਂ ਪੰਜਾਬੀ ਬੋਲਦੇ ਹਾਂ ਉਹ ਬੜੇ ਸੋ ਸਰਲ ਤਰੀਕੇ ਨਾਲ ਸਮਝ ਲੈਂਦੇ ਪੰਜਾਬੀ ਇਸ ਕਰਕੇ ਹੀ ਵਧੀਆ ਲੱਗਦੀ ਹੈ ਕਿਉਂਕਿ ਹਰ ਖੇਤਰ ਦੇ ਲੋਕ ਇਸ ਨੂੰ ਸਮਝ ਲੈਂਦੇ ਨੇ ਪ੍ਰੰਤੂ ਜਿਹੜੇ ਅਲੱਗ ਅਲੱਗ ਇਲਾਕੇ ਦੇ ਲੋਕ ਨੇ ਉਹ ਬੋਲਦੇ ਨੇ ਭਾਸ਼ਾ ਉਹ ਪੰਜਾਬੀ ਨਹੀਂ ਸਮਝ ਸਕਦੇ ਇਸ ਕਰਕੇ ਜਿਹੜੀ ਪੰਜਾਬੀ ਭਾਸ਼ਾ ਹੈ ਨਾ ਉਹ ਉਹ ਦੂਜੇ ਰਾਜ ਦੀਆਂ ਨਾਲੋ ਵੱਖਰੀ ਅਤੇ ਹੈ ਪਰ ਸੌਖੀ ਅਤੇ ਸਰਲ ਵੀ ਹੈ